ਜ਼ਿੰਦਗੀ ਵਿੱਚ ਵੱਡੀਆਂ ਚੁਣੌਤੀਆਂ 'ਚੋਂ ਸਭ ਤੋਂ ਵੱਡੀ ਚੁਣੌਤੀ ਮੇਰੇ ਲਈ ਯੂਨੀਵਰਸਿਟੀ ਦੇ ਵਿੱਚ ਆ ਕੇ ਪੜ੍ਹਾਈ ਸ਼ੁਰੂ ਕਰਨ ਦਾ ਵੱਡਾ ਮਸਲਾ ਸੀਗਾ ਜਦੋਂ ਲੋਕਡਾਊਨ ਚੱਲ ਰਿਹਾ ਸੀਗਾ ਤਾਂ ਮੈਂ ਯੂਨੀਵਰਸਿਟੀ ਦੇ ਵਿੱਚ ਐੱਲ ਐੱਲ ਬੀ ਦੇ ਵਿੱਚ ਐਡਮਿਸ਼ਨ ਲੈਣੀ ਸੀਗੀ ਤਾਂ ਸਭ ਤੋਂ ਪਹਿਲਾਂ ਜਿਹੜੀ ਵੱਡੀ ਚੁਣੌਤੀ ਮੈਨੂੰ ਮੇਰੇ ਘਰ ਦੇ ਵਿੱਚੋਂ ਪੇਸ਼ ਹੋਈ ਮੇਰੀ ਮਦਰ ਦਾ ਕਹਿਣਾ ਸੀਗਾ ਵੀ ਤੂੰ ਅੱਗੇ ਐੱਲ ਐੱਲ ਬੀ ਕਰਨੀ ਆ ਤਾਂ ਇੱਥੇ ਹੀ ਕੋਈ ਕੋਲੇਜ ਦੇ ਵਿੱਚ ਐੱਲ ਐੱਲ ਬੀ ਸ਼ੁਰੂ ਕਰ ਲੈ ਪਰ ਮੇਰਾ ਸਟਾਰਟਿੰਗ ਤੋਂ ਰਿਹਾ ਸੀਗਾ ਵੀ ਜੇ ਮੈਂ ਐੱਲ ਐੱਲ ਬੀ ਕਰਨੀ ਆ ਤਾਂ ਯੂਨੀਵਰਸਿਟੀ ਜਾ ਕੇ ਹੀ ਕਰਨੀ ਹੈਗੀ ਆਫਟਰ ਪਲੱਸ ਟੂ ਵੀ ਮੇਰਾ ਯੂਨੀਵਰਸਿਟੀ ਆਉਣ ਦਾ ਹੀ ਸੀਗਾ ਪਰ ਉਦੋਂ ਘਰ ਦੇ ਹਾਲਾਤ ਨਾ ਠੀਕ ਹੋਣ ਕਰਕੇ ਮੈਂ ਯੂਨੀਵਰਸਿਟੀ 'ਚ ਐਡਮਿਸ਼ਨ ਨਹੀਂ ਲੈ ਲੈ ਪਾਈ ਪਰ ਜਦੋਂ ਹੀ ਲੋਕਡਾਊਨ ਸਟਾਰਟ ਹੋਇਆ ਤਾਂ ਘਰਦਿਆਂ ਨੂੰ ਮਤਲਬ ਮੇਰੀ ਐਡਮਿਸ਼ਨ ਦੀ ਫਿਕਰ ਪੈ ਗਈ ਵੀ ਕੁੜੀ ਦੀ ਗਰੈਜੂਏਸ਼ਨ ਕੰਪਲੀਟ ਹੋ ਗਈ ਆ ਅੱਗੇ ਯੂਨੀਵਰਸਿਟੀ ਜਾਣ ਦੀ ਜਿੱਦ ਕਰ ਰਹੀ ਹੈਗੀ ਤਾਂ ਮੇਰੀ ਮਦਰ ਦਾ ਸੀਗਾ ਵੀ ਤੂੰ ਯੂਨੀਵਰਸਿਟੀ ਨਹੀਂ ਜਾਣਾ ਮਤਲਬ ਲਗਾਤਾਰ ਜਦੋਂ ਮੈਂ ਐਡਮਿਸ਼ਨ ਲੈਣੀ ਸੀ ਤਾਂ ਸਾਡੇ ਘਰ ਦੇ ਵਿੱਚ ਮਤਲਬ ਸਾਡਾ ਕਲੇਸ਼ ਚੱਲਦਾ ਸੀਗਾ ਮੇਰੀ ਮਦਰ ਦਾ ਕਹਿਣਾ ਸੀ ਤੂੰ ਨਹੀਂ ਜਾਣਾ ਮਤਲਬ ਮੇਰਾ ਆਪਦੀ ਜਿੱਦ ਦੇ ਅੜੇ ਰਹਿਣਾ ਸੀਗਾ ਵੀ ਮੈਂ ਯੂਨੀਵਰਸਿਟੀ ਜਾ ਕੇ ਹੀ ਆਪਦੀ ਜਿਹੜੀ ਅੱਗੇ ਦੀ ਪੜ੍ਹਾਈ ਆ ਉਹ ਸ਼ੁਰੂ ਕਰਨੀ ਹੈਗੀ ਕਿਉਂਕਿ ਘਰਦਿਆਂ ਦਾ ਇਹ ਹੁੰਦਾ ਗਾ ਵੀ ਜਦੋਂ ਉਹ ਆਮ ਸਮਾਜ ਦੇ ਵਿੱਚ ਵਿਚਰਦੇ ਹੈਗੇ ਤਾਂ ਜਿਹੜੀ ਲੋਕਾਂ ਦੀ ਮੈਂਟੈਲਿਟੀ ਹੈਗੀ ਮਤਲਬ ਕੁੜੀਆਂ ਪ੍ਰਤੀ ਬਹੁਤ ਹੀ ਬੇਕਾਰ ਹੈਗੀ ਉਹਨਾਂ ਨੂੰ ਇਹ ਲੱਗਦਾ ਗਾ ਵੀ ਕੁੜੀਆਂ ਘਰ ਤੋਂ ਬਾਹਰ ਜਾ ਕੇ ਪੜ੍ਹ ਨਹੀਂ ਸਕਦੀਆਂ ਹੈਗੀਆਂ ਤਾਂ ਜਦੋਂ ਮੈਂ ਆਪਣੇ ਘਰਦਿਆਂ ਨੂੰ ਆਪਣੇ ਸੁਪਨੇ ਬਾਰੇ ਦੱਸਿਆ ਤਾਂ ਜਦੋਂ ਹੀ ਘਰਦਿਆਂ ਦਾ ਇਸਦੇ ਵਿਰੁੱਧ ਰਿਐਕਸ਼ਨ ਆਉਣਾ ਸਟਾਰਟ ਹੋਇਆ ਤਾਂ ਮੈਂ ਹੌਲੀ ਹੌਲੀ ਕਰਕੇ ਐਡਮਿਸ਼ਨ ਲਈ ਯੂਨੀਵਰਸਿਟੀ ਦੇ ਵਿੱਚ ਘਰਦਿਆਂ ਨੂੰ ਸਮਝਾਇਆ ਹੌਲੀ ਹੌਲੀ ਮੇਰੇ ਘਰ ਦੇ ਇਸ ਨੂੰ ਲੈ ਕੇ ਮੰਨ ਗਏ ਤਾਂ ਅੱਜ ਵੀ ਜਦੋਂ ਮੈਂ ਘਰ ਜਾਂਦੀ ਹੈਗੀ ਤਾਂ ਹੁਣ ਲੋਕਾਂ ਦੀ ਮੇਰੇ ਪ੍ਰਤੀ ਮੈਂਟੈਲਿਟੀ ਥੋੜ੍ਹੀ ਚੇਂਜ ਹੋਈ ਹੈਗੀ ਤਾਂ ਜਦੋਂ ਹੀ ਮੈਂ ਘਰ ਜਾਂਦੀ ਹਾਂ ਤਾਂ ਉਹ ਪੁੱਛਦੇ ਆਗੇ ਵੀ ਤੇਰਾ ਕੋਰਸ ਕੰਪਲੀਟ ਹੋ ਗਿਆ ਤੂੰ ਕੀ ਕਰਦੀ ਆ ਕਦੋਂ ਲੱਗਣਾ ਹੈਗਾ ਕਦੋਂ ਜੋਬ ਕਰਨੀ ਹੈਗੀ ਤਾਂ ਪਹਿਲਾਂ ਇਹ ਹੁੰਦਾ ਸੀਗਾ ਵੀ ਉਹਨਾਂ ਨੂੰ ਮੇਰੇ ਵਿਆਹ ਦੀ ਫ਼ਿਕਰ ਹੁੰਦੀ ਸੀਗੀ ਵੀ ਕੁੜੀ ਦਾ ਵਿਆਹ ਕਰਨਾ ਪਰ ਅੱਜ ਮਤਲਬ ਉਹਨਾਂ ਦੀ ਆ ਜਿਹੜਾ ਮੈਂਟੈਲਿਟੀ ਹੈਗੀ ਮੇਰੇ ਪ੍ਰਤੀ ਬਹੁਤ ਚੇਂਜ ਹੋਈ ਹੈਗੀ ਤਾਂ ਇਸੇ ਤਰੀਕੇ ਦੇ ਨਾਲ ਮੈਂ ਲਗਾਤਾਰ ਜੋ ਵੀ ਅੱਗੇ ਕੋਈ ਚੁਣੌਤੀਆਂ ਆਉਂਦੀਆਂ ਨੇ ਉਹਨਾਂ ਨੂੰ ਇਸੇ ਤਰੀਕੇ ਨਾਲ ਫੇਸ ਕਰਾਂਗੀ ਅਤੇ ਅੱਗੇ ਵਧਾਂਗੀ